ਸ਼ੇਅਰ ਮਾਰਕੀਟ ਦੇ ਵਿੱਚ ਜਦੋਂ ਕਿਸੇ ਕੰਪਨੀ ਨੂੰ ਫੰਡਿੰਗ ਦੀ ਲੋੜ ਪੈਂਦੀ ਹੈ ਤਾਂ ਉਹ ਆਪਣਾ ਆਈ ਪੀ ਓ ਨਿਕਾਲਦੇ ਨੇ ਜਿਸ ਵਿੱਚ ਪ੍ਰਮੋਟਰਸ ਜਾਂ ਲੋਕ ਇਨਵੈਸਟ ਕਰਦੇ ਆ ਜੋ ਉਹ ਪੈਸਾ ਫਿਰ ਕੰਪਨੀ ਆਪਣੀ ਗਰੋਥ ਲਈ ਯੂਜ ਕਰਦੀ ਆ ਅਤੇ ਅੱਜ ਕੱਲ੍ਹ ਜੋ ਕਮਨਿਸਟ ਟਰੈਂਡਿੰਗ ਦੇ ਵਿੱਚ ਨੇ ਉਹ ਟਾਟਾ ਟਾਟਾ ਪਾਵਰ ਰਿਨਿਊਅਲ ਸੈਕਟਰ ਦੇ ਵਿੱਚ ਅਤੇ ਟਾਟਾ ਮੋਟਰ ਇਲੈਕਟ੍ਰੀਕਲ ਸੈਕਟਰ ਦੇ ਵਿੱਚ ਨੇ ਇਨ੍ਹਾਂ ਕੰਪਨੀਆਂ ਦੇ ਵਿੱਚ ਅੱਜ ਕੱਲ੍ਹ ਪੈਸਾ ਲਗਾਉਣਾ ਬਹੁਤ ਹੀ ਲਾਭਕਾਰੀ ਆ ਅਤੇ ਡਿਜ਼ੀਟਲ ਐਪ ਜੋ ਹੈ ਉਹ ਬਹੁਤ ਹੀ ਵਧੀਆ ਹੈ ਕਿਉਂਕਿ ਇਸਨੂੰ ਯੂਜ ਕਰਨਾ ਬਹੁਤ ਇਜੀ ਹੈ ਅਤੇ ਆਪਣਾ ਜੋ ਕੁਛ ਵੀ ਡਾਟਾ ਸ਼ੇਅਰ ਕਰਨਾ ਉਹ ਵੀ ਬਹੁਤ ਇਜੀ ਹੋ ਜਾਂਦਾ ਇਸ ਨਾਲ ਮਨੀ ਟਰਾਂਸੈਕਸ਼ਨ ਇਜੀ ਹੋ ਜਾਂਦੀ ਹੈ ਇਸ ਲਈ ਇਹ ਬਹੁਤ ਹੀ ਸਾਡੇ ਲਈ ਯੂਜਫੁੱਲ ਹੈ ਲਾਭਕਾਰੀ ਹੈ ਅਤੇ ਸਾਨੂੰ ਨਹੀਂ ਲੱਗਦਾ ਕਿ ਇਹ ਜੋ ਐਪਸ ਨੇ ਉਹ ਸਾਡੇ ਲਈ ਖ਼ਤਰਨਾਕ ਨੇ ਥੈਂਕ ਯੂ